ਮੈਂ ਤੁਹਾਡੇ ਐਮਾਜੋਨ ਕੰਪਨੀ ਦੇ ਥਰੂ ਕੁਛ ਕਿਤਾਬਾਂ ਮੰਗਵਾਈਆਂ ਸਨ ਈਬੁੱਕਸ ਜੋ ਮੈਨੂੰ ਬਹੁਤ ਚੰਗੀਆਂ ਲੱਗੀਆਂ ਇਹਨਾਂ ਕਿਤਾਬਾਂ ਨੂੰ ਤੁਸੀਂ ਜੋ ਭੇਜਣ ਦਾ ਪ੍ਰੋਸੈਸ ਬਣਾਇਆ ਹੈ ਬਹੁਤ ਵਧੀਆ ਹੈ ਔਰ ਮੈਨੂੰ ਜਲਦੀ ਹਾਸਲ ਹੋ ਗਈਆਂ ਔਰ ਵਾਜਿਬ ਕੀਮਤਾਂ 'ਤੇ ਮੈਨੂੰ ਮਿਲੀਆਂ ਨੇ ਅਤੇ ਇਸ 'ਤੇ ਮੈਨੂੰ ਬਹੁਤ ਖੁਸ਼ੀ ਔਰ ਕਿਤਾਬਾਂ ਦੇ ਜੋ ਫੋਰਮੈਟਿੰਗ ਆ ਜਾਂ ਉਹਨਾਂ ਦਾ ਫੋਂਟ ਵਗੈਰਾ ਈਬੁੱਕਸ ਦ ਦੇ ਵਿੱਚ ਵੀ ਬਹੁਤ ਸੁੰਦਰ ਬਣਿਆ ਹੋਇਆ ਕਿਤਾਬਾਂ ਵੀ ਬਹੁਤ ਅੱਛੀਆਂ ਹਨ ਔਰ ਤੁਹਾਡੀ ਕਿਤਾਬਾਂ ਨੂੰ ਡਿਲੀਵਰੀ ਕਰਨ ਦਾ ਜੋ ਤਰੀਕਾ ਹੈ ਉਹ ਵੀ ਮੈਨੂੰ ਚੰਗਾ ਲੱਗਿਆ ਔਰ ਉਹ ਮੈਨੂੰ ਈਮੇਲ ਦੇ ਰਾਹੀਂ ਪ੍ਰਾਪਤ ਹੋ ਗਈਆਂ ਅਤੇ ਮੈਨੂੰ ਪੇਮੈਂਟ ਕਰਨ ਦੇ ਵਿੱਚ ਵੀ ਕੋਈ ਔਖ ਨਹੀਂ ਹੋਈ ਅਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੀ